ਗੁਡ ਮੋਰਨਿੰਗ

ਹਾਂਜੀ ਹਾਂਜੀ ਬੇਟਾ ਬੋਲੋ

ਠੀਕ ਹੈ ਜੀ ਹਾਂਜੀ ਬੇਟਾ ਹਾਂਜੀ ਠੀਕ ਹੈ ਠੀਕ ਹੈ

ਹਾਂਜੀ ਠੀਕ ਹੈ ਬੇਟਾ ਦੇਖੋ ਜੇ ਤਾਂ ਤੁਸੀਂ ਇੰਡਸਟਰੀ 'ਚ ਕੰਮ ਕਰਨਾ ਚਾਹੁੰਦੇ ਹੋ ਉਹ ਤਾਂ ਬਠਿੰਡਾ 'ਚ ਤੁਹਾਨੂੰ ਪਤਾ ਜ਼ਿਆਦਾ ਟੋਪ ਲੈਵਲ ਦੀ ਇੰਡਸਟਰੀਜ਼ ਤਾਂ ਨਹੀਂ ਹੈ ਇੱਕ ਐੱਚ ਐੱਮ ਈ ਐੱਲ ਹੈ ਇੱਥੇ ਇੱਕ ਤੁਹਾਨੂੰ ਇੱਥੇ ਜੋਬ ਮਿਲ ਸਕਦੀ ਹੈ ਆ ਐੱਚ ਐੱਮ ਈ ਐੱਲ ਵਗੈਰਾ 'ਚ ਜਾਂ ਫਿਰ ਜੇ ਤੁਸੀਂ ਟੀਚਿੰਗ 'ਚ ਜਾਓਗੇ ਤਾਂ ਦੋ ਤਿੰਨ ਅੱਛੀਆਂ ਯੂਨੀਵਰਸਿਟੀ ਜੋ ਤੁਹਾਨੂੰ ਬਠਿੰਡੇ 'ਚ ਜਾਂ ਬਠਿੰਡੇ ਦੇ ਲਾਗੇ ਪੈਂਦੀ ਹੈ ਜਿਵੇਂ ਇੱਕ ਤਾਂ ਤੁਹਾਡੀ ਆਪਣੀ ਆਪਣੀ ਯੂਨੀਵਰਸਿਟੀ ਹੈ ਜੇ ਤੁਸੀਂ ਇੱਥੇ ਜੋਬ ਕਰਨਾ ਚਾਹੁੰਦੇ ਹੋ ਤਾਂ ਕੌਂਟਰੈਕਟ ਵਗੈਰਾ 'ਤੇ ਲੇਟਰੋਨ ਵਕੈਂਸੀਜ ਨਿਕਲਦੀਆਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਫਿਰ ਅਕਾਲ ਯੂਨੀਵਰਸਿਟੀ ਹੈ ਤਲਵੰਡੀ ਸਾਬੋ ਉਹਦੇ 'ਚ ਵੀ ਅੱਛਾ ਪੈਕਜ ਮਿਲਦਾ ਪ੍ਰਾਈਵੇਟ ਹੈ ਪਰ ਅੱਛਾ ਮਿਲ ਜਾਂਦਾ ਪੈਕੇਜ ਫਿਰ ਇੱਧਰ ਐੱਮ ਆਰ ਐੱਸ ਪੀ ਟੀ ਯੂ ਹੈ ਗਿਆਨੀ ਜੈਲ ਸਿੰਘ ਕਿਉਂਕਿ ਉੱਥੇ ਵੀ ਅਗਰ ਪੋਸਟ ਨਿਕਲਦੀ ਹੈ ਤਾਂ ਅਪਲਾਈ ਕਰ ਸਕਦੇ ਹੋ ਬਾਕੀ ਅਸੀਂ ਥੋੜ੍ਹਾ ਬਹੁਤ ਫਰੀਕੁਇੰਟਲੀ ਨਾ ਪੋਸਟ ਕਰਦੇ ਰਹਿੰਦੇ ਹਾਂ ਕਿ ਇਹ ਜੋਬ ਹੈ ਇਹ ਜੋਬ ਹੈ ਤੁਹਾਨੂੰ ਅਸੀਂ ਕੋਈ ਵਟਸਐਪ ਗਰੁੱਪ 'ਚ ਐਡ ਕਰ ਲਵਾਂਗੇ ਤੁਸੀਂ ਆਪਣਾ ਨੰਬਰ ਵਗੈਰਾ ਤਾਂ ਮੇਰੇ ਕੋਲ ਆ ਹੀ ਗਿਆ ਤੁਹਾਡਾ ਤਾਂ ਮੈਂ ਤੁਹਾਨੂੰ ਐਡ ਕਰ ਦਾਂਗੀ ਵਟਸਅੱਪ ਗਰੁੱਪ 'ਚ ਉਹਦੇ 'ਚ ਅਸੀਂ ਪੋਸਟ ਕਰਦੇ ਰਹਿੰਦੇ ਹਾਂ ਕਿ ਕੀ ਕੀ ਫੈਸਿਲਿਟੀਜ਼ ਹੈ ਕਿਹੜੀ ਕਿਹੜੀ ਜੋਬਸ ਮਿਲ ਰਹੀਆਂ ਜਾਂ ਜਿੱਦਾਂ ਤਾਂ ਤੁਸੀਂ ਕਰ ਸਕਦੇ ਹੋ ਇੱਥੋਂ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਜਿੱਦਾਂ ਐੱਚ ਏ ਐੱਮ ਈ ਐੱਲ ਦਾ ਨਾ ਥੋੜ੍ਹਾ ਲਿੰਕ ਹੈ ਵਿਪਰੋ ਉਹਦੇ ਨਾਲ ਤਾਂ ਵਿਪਰੋ ਵਗੈਰਾ ਪਲੇਸਮੈਂਟ ਕਰਵਾਉਂਦੀ ਹੈ ਉਹ ਐੱਚ ਐੱਮ ਈ ਐੱਲ 'ਚ ਰਿਕਰੂਟ ਕਰਵਾ ਦਿੰਦੀ ਹੈ ਬਟ ਉਹ ਫਿਲਹਾਲ ਤਾਂ ਕੋਈ ਵੈਕੈਂਸੀ ਹੈ ਨਹੀਂ ਹੈ ਅਤੇ ਜਦੋਂ ਵੀ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਜੇ ਜੇ ਤੁਹਾਡਾ ਇੰਡਸਟਰੀ 'ਚ ਇੰਟਰਸਟ ਹੈ ਤਾਂ ਤੁਹਾਨੂੰ ਅਸੀਂ ਉਸ ਤਰ੍ਹਾਂ ਅਪਡੇਟ ਕਰਦੇ ਰਹਾਂਗੇ ਜੇ ਤੁਹਾਡਾ ਟੀਚਿੰਗ 'ਚ ਹੈ ਜਾਂ ਰਿਸਰਚ 'ਚ ਇੰਟਰਸਟ ਹੈ ਤਾਂ ਉਸ ਹਿਸਾਬ ਨਾਲ ਤੁਹਾਨੂੰ ਅਪਡੇਟ ਕਰਦੇ ਰਹਾਂਗੇ

ਠੀਕ ਹੈ ਠੀਕ ਹੈ ਬੇਟਾ ਅ

ਠੀਕ ਹੈ ਠੀਕ ਹੈ ਬੇਟਾ ਐੱਚ ਐੱਮ ਈ ਐੱਲ 'ਚ ਪੈਕਜ ਤਾਂ ਅੱਛਾ ਹੀ ਦਿੰਦੇ ਆ ਬਟ ਉੱਥੇ ਵੈਕੈਂਸੀ ਥੋੜ੍ਹੀ ਲੇਟ ਨਿਕਲਦੀ ਹੈ ਦੂਸਰੇ ਫੀਲਡ 'ਚ ਤਾਂ ਨਿਕਲ ਜਾਂਦੀ ਕੰਪਿਊਟਰ ਸਾਇੰਸ 'ਚ ਥੋੜ੍ਹੀ ਘੱਟ ਰਹਿੰਦੀ ਹੈ ਬਟ ਠੀਕ ਹੈ ਅਸੀਂ ਟਰਾਈ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਬੇਟਾ ਸ਼ੋਰ ਸ਼ੋਰ ਠੀਕ ਹੈ ਬੇਟਾ ਥੈਂਕ ਯੂ ਓਕੇ ਓਕੇ ਓਕੇ